ਹਾਂ ਮੈਨੂੰ ਇੱਕ ਵਾਰੀ ਯਾਦ ਹੈ ਕਿ ਜਦੋਂ ਅਸੀਂ ਮੈਂ ਅਤੇ ਮੇਰਾ ਪੂਰਾ ਪਰਿਵਾਰ ਪਟਿਆਲੇ ਜਾ ਰਿਹਾ ਸੀ ਨਕੋਦਰ ਘੁੰਮਣ ਦੇ ਲਈ ਤਾਂ ਉਸ ਟਾਈਮ ਮੇ ਸਾਨੂੰ ਕਿਸੇ ਨੂੰ ਵੀ ਉਸ ਦਾ ਰਸਤਾ ਨਹੀਂ ਸੀ ਪਤਾ ਤਾਂ ਉਸ ਟਾਈਮ ਅਸੀਂ ਗੂਗਲ ਮੈਪ ਦੀ ਹੈਲਪ ਲਿੱਤੀ ਸੀ ਉਸ ਉਸ ਜਗ੍ਹਾ ਨੂੰ ਮਤਲਬ ਫਾਇੰਡ ਕਰਨ ਵਾਸਤੇ ਵੀ ਸਾਨੂੰ ਰਸਤੇ ਦੇ ਵਿੱਚ ਮੇਰੇ ਪਾਪਾ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਅਸੀਂ ਕਿਸ ਸਾਈ ਸਾਈਡ ਜਾਈਏ ਤਾਂ ਫਿਰ ਮੇਰੇ ਬ੍ਰਦਰ ਨੇ ਉਹਨਾਂ ਨੂੰ ਸੁਝਾਅ ਦਿੱਤਾ ਕਿ ਤੁਸੀਂ ਗੂਗਲ ਮੈਪ 'ਤੇ ਫਾਇੰਡ ਕਰੋ ਉਸ ਲੋਕੇਸ਼ਨ ਦੇ ਜਾ ਲੋਕੇਸ਼ਨ ਦਾ ਨਾਮ ਦੱਸੋ ਅਤੇ ਉਸ ਨੂੰ ਫਾਇੰਡ ਕਰੋ ਤਾਂ ਸਾ ਅਸੀਂ ਬਹੁਤ ਈਜ਼ੀਲੀ ਤਰੀਕੇ ਨਾਲ ਅਸੀਂ ਉੱਥੇ ਪਹੁੰਚ ਗਏ ਉਹ ਗੂਗਲ ਮੈਪ ਦੇ ਉੱਤੇ ਉਹ ਆਪਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਕਾਰੀ ਦੇ ਦਿੰਦੇ ਹੈ ਜਿੱਥੇ ਕਿ ਆਪਾਂ ਜਾਣਾ ਹੁੰਦਾ ਹੈਗਾ ਜਿਵੇਂ ਕਿ ਉਹ ਆਪਾਂ ਨੂੰ ਜੇ ਕੋਈ ਮੋੜ ਆਉਂਦਾ ਹੈਗਾ ਤਾਂ ਆਪਾਂ ਨੂੰ ਉਸ ਬਾਰੇ ਵੀ ਸਾਨੂੰ ਜਾਣਕਾਰੀ ਦੇ ਦਿੰਦੇ ਹੈ ਕਿ ਹੁਣ ਲੈਫਟ ਸਾਇਡ ਮੋੜ ਹੈ ਜਾਂ ਰਾਇਟ ਸਾਇਡ ਮੋੜ ਹੈ ਤਾਂ ਉਹ ਆਪਾਂ ਨੂੰ ਵਿੱਚੋਂ ਆਉਣ ਵਾਲੇ ਪੈਟ੍ਰੋਲ ਪੰਪ ਜਾਂ ਫਿਰ ਕੋਈ ਵੀ ਚੀਜ਼ ਹੁੰਦੀ ਹੈ ਜਿੱਥੇ ਆਪਾਂ ਖੜ੍ਹ ਕੇ ਆਰਾਮ ਕਰ ਸਕਦੇ ਹਾਂ ਕੋਈ ਢਾਬਾ ਵਗੈਰਾ ਐਵੇਂ ਦੀ ਚੀਜ਼ਾਂ ਬਾਰੇ ਵੀ ਦੱਸ ਦਿੰਦੇ ਆ ਤਾਂ ਅ ਉਸ ਟਾ ਉਹ ਹੀ ਇੱਕ ਟਾਈਮ ਸੀ ਜਦੋਂ ਕਿ ਅਸੀਂ ਗੂਗਲ ਮੈਪ ਦੀ ਅ ਵਰਤੋਂ ਕੀਤੀ ਸੀ ਇਹ ਗੂਗਲ ਮੈਪ ਬਹੁਤ ਅ ਚੰਗੀ ਚੀਜ਼ ਹੈ ਅਤੇ ਮੋਸਟਲੀ ਅੱਜ ਕੱਲ੍ਹ ਬਹੁਤ ਸਾਰੇ ਲੋਕ ਹਨ ਜਦੋਂ ਕਿਸੇ ਪਾਸੇ ਵਿਜਿਟ ਕਰਦੇ ਹਨ ਅਤੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਉਹ ਕਿੱਥੇ ਜਾ ਰਹੇ ਹਨ ਦਾ ਉਹਨਾਂ ਨੇ ਇਹ ਉਹ ਇਸ ਗੂਗਲ ਮੈਪ ਦੀ ਅ ਮਦਦ ਲੈ ਲੈਂਦੇ ਹਨ ਇਹ ਇੱਕ ਬਹੁਤ ਚੰਗਾ ਇ ਟੈਕਨੋਲੋਜੀ ਦਾ ਪਾਰਟ ਹੈ ਕਿ ਬੰਦਾ ਇਜੀਲੀ ਕਿਸੇ ਵੀ ਜਿਹੜੀ ਜਗ੍ਹਾ ਤੋਂ ਉਸਨੂੰ ਪਤਾ ਵੀ ਨਹੀਂ ਹੈ ਜਿਹੜੇ ਰਸਤੇ ਦਾ ਉਨੂੰ ਉਸਨੂੰ ਪਤਾ ਵੀ ਨਹੀਂ ਆ ਉਹ ਗੂਗਲ ਮੈਪ ਦੇ ਰਾਹੀਂ ਫਾਇੰਡ ਕਰ ਸਕਦਾ ਉਹ ਉਸ ਜਗ੍ਹਾ ਨੂੰ ਗੂਗਲ ਮੈਪ ਦੇ ਰਾਹੀਂ ਫਾਇੰਡ ਕਰ ਸਕਦਾ ਅਤੇ ਉਸ ਚੀਜ਼ ਨੂੰ ਉੱਥੇ ਵਿਜਿਟ ਕਰ ਸਕਦਾ ਤਾਂ ਕਰਕੇ ਗੂਗਲ ਮੈਪ ਇੱਕ ਬਹੁਤ ਹੀ ਵਧੀਆ ਸਾਧਨ ਹੈ